ਇੱਕ ਜੁਲਾਈ ਇੱਕ ਸੱਤ ਦੋ ਹਜ਼ਾਰ ਚੌਵੀ ਇੱਕ ਛੇ ਸੱਤ ਦੋ ਹਜ਼ਾਰ ਚੌਵੀ ਤੇਰਾਂ ਸੱਤ ਦੋ ਹਜ਼ਾਰ ਚੌਵੀ ਸੋਲ੍ਹਾਂ ਸੱਤ ਦੋ ਹਜ਼ਾਰ ਚੌਵੀ ਅਠਾਰਾਂ ਨੌਂ ਦੋ ਹਜ਼ਾਰ ਚੌਵੀ